ਓਲਾ ਕੰਪਨੀ ਨੂੰ ਇਹ ਕੰਪਲੇਂਟ ਲਿਖਾਉਣਾ ਚਾਹੁੰਦਾ ਹਾਂ ਕਿ ਮੈਂ ਪੰਦਰਾਂ ਮਾਰਚ ਨੂੰ ਓਲਾ ਦੀ ਇੱਕ ਕੈਬ ਬੁੱਕ ਕਰਵਾਈ ਮੈਂ ਇੱਕ ਜ਼ਰੂਰੀ ਮੀਟਿੰਗ ਵਿੱਚ ਪਹੁੰਚਣਾ ਸੀ ਮੇਰੇ ਕੋਲ ਇੱਕ ਲਾਲ ਰੰਗ ਦੀ ਸਵਿਫਟ ਗੱਡੀ ਆਈ ਜਦੋਂ ਕੈਬ ਆਈ ਤਾਂ ਮੈਂ ਦੇਖਿਆ ਕਿ ਉਸ ਦੀ ਹਾਲਤ ਬਹੁਤ ਖ਼ਰਾਬ ਸੀ ਮੈਂ ਡਰਾਈਵਰ ਨੂੰ ਇਸ ਬਾਰੇ ਇਤਰਾਜ ਜਤਾਇਆ ਸੀਟਾਂ ਫਟੀਆਂ ਹੋਈਆਂ ਸਨ ਏ ਸੀ ਵੀ ਸਹੀ ਤਰ੍ਹਾਂ ਨਹੀਂ ਸੀ ਚੱਲ ਰਿਹਾ ਗੱਡੀ ਦੇ ਟਾਇਰ ਵੀ ਘਸੇ ਹੋਏ ਸਨ ਗੱਡੀ ਦਾ ਹੋਰਨ ਵੀ ਸਹੀ ਤਰ੍ਹਾਂ ਕੰਮ ਨਹੀਂ ਸੀ ਕਰ ਰਿਹਾ ਗੱਡੀ ਸਟਾਰਟ ਨਹੀਂ ਸੀ ਹੋ ਰਹੀ ਮੈਂ ਅਤੇ ਆਸ ਪਾਸ ਤੇ ਦੋ ਹੋਰ ਜਣਿਆਂ ਨੇ ਧੱਕਾ ਮਾਰ ਕੇ ਗੱਡੀ ਨੂੰ ਸਟਾਰਟ ਕਰਾਇਆ ਰਸਤੇ ਵਿੱਚ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਗੱਡੀ ਨੂੰ ਪੈਂਚਰ ਲਗਵਾ ਕੇ ਅਸੀਂ ਉੱਥੋਂ ਚੱਲੇ ਤਾਂ ਗੱਡੀ ਬਹੁਤ ਅਵਾਜ ਕਰ ਰਹੀ ਸੀ ਗੱਡੀ ਦੀ ਹਾਲਤ ਬਹੁਤ ਖ਼ਰਾਬ ਸੀ ਗੱਡੀ ਦੇ ਸ਼ੋਕਰ ਖ਼ਰਾਬ ਹੋਣ ਕਰਕੇ ਬਹੁਤ ਝਟਕੇ ਲੱਗ ਰਹੇ ਸਨ ਗੱਡੀ ਦਾ ਇੰਜਨ ਆਵਾਜ਼ਾਂ ਕਰ ਰਿਹਾ ਸੀ ਅਤੇ ਗਰਮ ਹੋ ਰਿਹਾ ਸੀ ਗੱਡੀ ਦਾ ਪੇਂਟ ਕਈ ਥਾਵਾਂ ਤੋਂ ਉਤਰਿਆ ਹੋਇਆ ਸੀ ਗੱਡੀ ਦੇ ਬੋਨਟ 'ਤੇ ਵੀ ਡੈਂਟ ਪਏ ਹੋਏ ਸਨ ਗੱਡੀ ਦੀ ਹੈਡਲਾਈਟ ਆ ਨਹੀਂ ਸੀ ਚੱਲ ਰਹੀਆਂ ਗੱਡੀ ਦੀ ਬਰੇਕਾਂ ਘੱਸ ਗਈਆਂ ਸਨ ਅਤੇ ਉਹ ਵੀ ਠੀਕ ਤਰ੍ਹਾਂ ਨਹੀਂ ਸੀ ਲੱਗ ਰਹੀਆਂ ਗੱਡੀ ਦੀ ਖ਼ਰਾਬ ਹਾਲਤ ਕਰਕੇ ਮੈਂ ਮੀਟਿੰਗ ਵਿੱਚ ਸਮੇਂ ਸਿਰ ਨਹੀਂ ਪਹੁੰਚ ਪਾਇਆ ਅਤੇ ਇਸ ਕਰਕੇ ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ